ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਦੱਸੋ ਹਾਂਜੀ ਹਾਂਜੀ ਓਕੇ ਮੈਮ ਹਾਂਜੀ ਮੈਮ ਸਾਡੇ ਕੋਲ ਸਾਰਾ ਸਟੇਸ਼ਨਰੀ ਦਾ ਆ ਤੁਹਾਨੂੰ ਜੋ ਵੀ ਚਾਹੀਦਾ ਹੈ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਹਾਂਜੀ ਮੈਮ ਉਹ ਵੀ ਮਿਲ ਜਾਣਗੀਆਂ ਹੋਰ ਤੁਹਾਨੂੰ ਕਲਰਫੁੱਲ ਟੇਪ ਵਗੈਰਾ ਕੁਛ ਚਾਹੀਦੀਆਂ ਹੋਣ ਡੈਕੋਰੇਸ਼ਨ ਕਰਨ ਲਈ ਓਕੇ ਮੈਮ ਹਾਂਜੀ ਮੈਮ ਹਾਂਜੀ ਮੈਮ ਮਿਲ ਜਾਏਗਾ ਹਾਂਜੀ ਹਾਂਜੀ ਹਾਂਜੀ ਮੈਮ ਅਵੇਲੇਬਲ ਨੇ ਤੁਸੀਂ ਬਾਏ ਕਰ ਸਕਦੇ ਹੋ ਮੈਮ ਸੈਕਿੰਡ ਸਟੈਂਡਰਡ ਦੀਆਂ ਮਿਲ ਜਾਣਗੀਆਂ ਬੀ ਸੈਕਸ਼ਨ ਦੀਆਂ ਹਾਂਜੀ ਮੈਮ ਉਹ ਵੀ ਮਿਲ ਜਾਏਗਾ ਅਵੇਲੇਬਲ ਹੈ ਤੁਸੀਂ ਇੱਕ ਵੀਕ ਪਹਿਲਾਂ ਇਨਫੋਰਮ ਕਰ ਦੇਣਾ ਤਾਂ ਕਿ ਅਸੀਂ ਕੁਆਂਟਿਟੀ ਤੁਹਾਨੂੰ ਦੱਸ ਸਕੀਏ ਮੈਮ ਇਹਦੇ ਵਿੱਚ ਤੁਹਾਨੂੰ ਫਾਈਵ ਹੰਡਰਡ ਟੂ ਸੈਵਨ ਹੰਡਰਡ ਪੈ ਜਾਏਗੀ ਮੈਕਸੀਮਮ ਬਾਕੀ ਤੁਸੀਂ ਸਾਡੇ ਕਸਟਮਰ ਹੋ ਪਹਿਲਾਂ ਦੇ ਅਤੇ ਤੁਸੀਂ ਇੱਕ ਵਾਰ ਆ ਕੇ ਵਿਜ਼ਿਟ ਕਰ ਲੈਣਾ ਅਸੀਂ ਤੁਹਾਨੂੰ ਦੱਸ ਦਵਾਂਗੇ ਮੈਮ ਉਹਦੀਆਂ ਤੁਹਾਨੂੰ ਉਸ ਦੀਆਂ ਵਨ ਥਾਊਸ ਵਨ ਥਾਊਸੰਡ ਟੂ ਟਵੈਲਵ ਹਨ ਥਾਊਸੰਡ ਪੈ ਜਾਏਗਾ ਹਾਂਜੀ ਮੈਮ ਸਾਡੇ ਕੋਲ ਫ ਫਸਟ ਕਲਾਸ ਤੋਂ ਲੈ ਕੇ ਅੱਠ ਇਲੈਵੰਥ ਸਟੈਂਡਰਡ ਤੱਕ ਬੁੱਕਸ ਮਿਲ ਅਵੇਲੇਬਲ ਨੇ ਚਾਹੇ ਤੁਸੀ ਸੈਕਿੰਡ ਹੈਂਡ ਬਾਏ ਕਰ ਸਕਦੇ ਹੋ ਇਹ ਤੁਹਾਡੀ ਵਿਸ਼ ਹੈ ਤੁਸੀਂ ਸੈਕਿੰਡ ਹੈਂਡ ਬਾਏ ਕਰਨਾ ਚਾਹੁੰਦੇ ਹੋ ਜਾਂ ਫਿਰ ਨਿਊ ਹਾਂਜੀ ਮੈਮ ਫਿਫਥ ਕਲਾਸ ਲਈ ਮੈਮ ਹਾਂਜੀ ਮੈਮ ਉਹਨਾਂ ਦਾ ਤੁਹਾਨੂੰ ਥ੍ਰੀ ਹੰਡਰਡ ਟੂ ਫੋਰ ਹੰਡਰਡ ਮੈਕਸੀਮਮ ਪ੍ਰਾਈਜ਼ ਮਿਲ ਜਾਏਗਾ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਤੁਹਾਡਾ ਅਪਰੋਕਸੀਮੇਟਲੀ ਮੈਮ ਵਨ ਫਾਈਵ ਹੰਡਰਡ ਰੁਪਈਸ ਤੁਸੀਂ ਓਨਲਾਈਨ ਮੈਮ ਤੁਹਾਨੂੰ ਜਾਇਜ਼ਾ ਲਾਇਆ ਹੈ ਥੈਂਕ ਯੂ ਮੈਮ